ਤੁਸੀਂ ਕਿਵੇਂ ਸੋਚਦੇ ਹੋ ਕਿ ਕੇ ਕਿ ਪੰਜਾਬੀ ਭਾਸ਼ਾ ਦੀ ਤੁਲਨਾ ਹੋਰਨਾ ਭਾਸ਼ਾ ਨਾਲੋਂ ਕੀਤੀ ਜਾਂਦੀ ਹੈ ਤੁਸੀਂ ਜੋ ਤੁਸੀਂ ਜਾਣਦੇ ਹੋ ਹਾਂ ਸਰ ਪੰਜਾਬੀ ਭਾਸ਼ਾ ਸਾਡੀ ਮਾਤ ਭਾਸ਼ਾ ਹੈ ਇਹਨੂੰ ਬੋਲਣ ਵਿੱਚ ਅਸੀਂ ਜਮਾਂ ਝਿਜਕ ਨਹੀਂ ਕਰਦੇ ਕਿਉਂਕਿ ਸਾਡੀ ਜਿਹੜੀ ਭਾਰਤੀ ਮਾਂ ਬੋਲੀ ਪੰਜਾਬੀ ਬੋਲੀ ਹੈ ਇਹ ਸ਼ੁਰੂ ਤੋਂ ਹੀ ਸਾਨੂੰ ਸਿਖਾਈ ਜਾਂਦੀ ਹੈ ਪਰ ਹੁਣ ਸਕੂਲਾਂ ਕਾਲਜਾਂ ਦੇ ਵਿੱਚ ਸਾਰਾ ਮੀਡੀਅਮ ਇੰਗਲਿਸ਼ ਦੇ ਵਿੱਚ ਬਦਲਿਆ ਜਾਂਦਾ ਉੱਥੇ ਵੀ ਬੋਰਡ ਇੰਗਲਿਸ਼ ਹਿੰਦੀ ਵਿੱਚ ਲਾਏ ਜਾਂਦੇ ਹਨ ਠੀਕ ਹੈ ਸਰ ਉਹਦੇ ਕਰਕੇ ਜਿਹੜੀ ਪੰਜਾਬੀ ਭਾਸ਼ਾ ਉਹ ਲੋਕਾਂ ਦੇ ਥੋੜ੍ਹੀ ਘੱਟਦੀ ਜਾਂਦੀ ਆ ਪਰ ਜਿਹੜੇ ਸਾਡੇ ਬਾਹਰਲੇ ਕੰਟਰੀਆਂ ਵਿੱਚ ਪੰਜਾਬੀ ਨੌਜਵਾਨ ਮੁੰਡੇ ਜਾਂ ਹੋਰ ਮਾਤਾ ਬਜ਼ੁਰਗ ਗਏ ਹੋਏ ਹਨ ਉਹ ਪੰਜਾਬੀ ਭਾਸ਼ਾ ਬੋਲਣ ਤੋਂ ਬਿਲਕੁਲ ਨਹੀਂ ਝਿਜਕਦੇ ਕਿਉਂਕਿ ਜਿਹੜੀ ਪੰਜਾਬੀ ਭਾਸ਼ਾ ਸਾਡੀ ਇਹ ਮਾਤ ਭਾਸ਼ਾ ਇਹਨੂੰ ਅਸੀਂ ਕਦੇ ਨਹੀਂ ਸਰ ਭੁੱਲ ਸਕਦੇ ਪੰਜਾਬੀ ਭਾਸ਼ਾ ਇਹ ਕੁਦਰਤੀ ਮਹਾਰਾਜ ਵੱਲੋਂ ਰਾਜੇ ਮਹਾਰਾਜਿਆਂ ਵੱਲੋਂ ਜਾ ਕੇ ਗੁਰੂਆਂ ਮਹਾਰਾਜਿਆਂ ਦੀ ਲਿਖੀ ਹੋਈ ਭਾਸ਼ਾ ਜਿਹਦਾ ਅਸੀਂ ਬਹੁਤ ਜ਼ਿਆਦਾ ਸਤਿਕਾਰ ਕਰਦੇ ਆ ਸਰ ਜੀ ਪੰਜਾਬੀ ਭਾਸ਼ਾ ਨੂੰ ਅਸੀਂ ਛੱਡ ਨਹੀਂ ਸਕਦੇ ਸਕੂਲਾਂ ਕਾਲਜਾਂ ਦੇ ਵਿੱਚ ਜਿਹੜੇ ਬੱਚੇ ਆ ਉਹਨਾਂ ਨੂੰ ਹੁਣ ਇੰਗਲਿਸ਼ ਮੀਡੀਅਮ ਹੋਣ ਕਾਰਨ ਉਹਨਾਂ ਨੂੰ ਹਿੰਦੀ ਇੰਗਲਿਸ਼ ਜਿਹੜੀਆਂ ਕਿ ਹੁਣ ਪੈਨਲ ਬੋਰਡ ਵੀ ਸਕੂਲਾਂ ਕਾਲਜ ਦੇ ਵਿੱਚ ਲੱਗੇ ਆ ਉਹ ਹਿੰਦੀ ਜਾਂ ਇੰਗਲਿਸ਼ ਵਿੱਚ ਹੀ ਲੱਗੇ ਹੋਏ ਹਨ ਪਰ ਹੁਣ ਲੱਖੇ ਸਿਧਾਣੇ ਵਰਗਿਆਂ ਨੇ ਕਹਿ ਤਾ ਕਹਿ ਦਿੱਤਾ ਕਿ ਪੰਜਾਬੀ ਭਾਸ਼ਾ ਉੱਤੇ ਵੱਧ ਤੋਂ ਵੱਧ ਜ਼ੋਰ ਦਿੱਤਾ ਜਾਵੇ ਤਾਂ ਕਿ ਬੱਚਿਆਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੀ ਕੋਈ ਪ੍ਰੋਬਲਮ ਨਾ ਆਵੇ ਤਾਂ ਜੋ ਕਿ ਉਹ ਆਪਣੀ ਮਾਤ ਭਾਸ਼ਾ ਨੂੰ ਭੁੱਲ ਜਾ ਸਕਣ ਥੈਂਕ ਯੂ